ਨਮਸਕਾਰ ਸਰ ਜੀ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ

ਮੇਰੇ ਮਾਤਾ ਜੀ ਜਦੋਂ ਮੈਂ ਛੋਟੀ ਸੀ ਅਤੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਸੀ ਖਾਣਾ ਬਣਾਉਣ ਦਾ ਜਦੋਂ ਵੀ ਮੇਰੇ ਮਾਤਾ ਜੀ ਖਾਣਾ ਬਣਾਉਂਦੇ ਸੀ ਮੈਂ ਉਹਨਾਂ ਕੋਲ ਬੈਠ ਕੇ ਖਾਣਾ ਬਣਾਉਣਾ ਸਿੱਖਦੀ ਸੀ ਅਤੇ ਇਹੀ ਸ਼ੌਂਕ ਕਰਕੇ ਮੈਨੂੰ ਹੁਣ ਕਿ ਮੈਂ ਸਭ ਕੁਛ ਬਣਾ ਲੈਂਦੀ ਹਾਂ ਜਿਵੇਂ ਕਿ ਪੂਰੀਆਂ ਚਨੇ ਪਾਲਕ ਪਨੀਰ ਡੋਸਾ ਆਦਿ ਹੀ ਭਰੀ ਹੋਈ ਹ ਸ਼ਿਮਲਾ ਮਿਰਚ ਅਤੇ ਕੋਈ ਵੀ ਡਿਸ਼ ਬਣਾ ਲੈਂਦੀ ਹਾਂ ਇਸ ਤੋਂ ਇਲਾਵਾ ਕਿ ਮੈਂ ਹਰ ਕੋਈ ਅਚਾਰ ਦੀ ਰੈਸਪੀ ਵੀ ਤਿਆਰ ਕਰ ਲੈਂਦੀ ਹਾਂ ਹਰ ਕੋਈ ਅਚਾਰ ਵੀ ਪਾ ਲੈਂਦੀ ਹਾਂ ਅਤੇ ਅ ਜਿ ਜਿੰਨਾ ਕਿ ਮੈਨੂੰ ਇੰਨਾ ਸ਼ੌਂਕ ਸੀ ਕਿ ਹੁਣ ਚਿਕਨ ਵਗੈਰਾ ਵੀ ਮੈਂ ਆਪਣੇ ਜਦੋਂ ਪਰਿਵਾਰ ਵਿੱਚ ਮੈਰਿਜ ਤੋਂ ਬਾਅਦ ਆਪਣੇ ਪੇਕੇ ਘਰ ਜਾਂਦੀ ਹਾਂ ਤਾਂ ਮੇਰੇ ਸਿਸਟਰ ਜਾਂ ਮੇਰੇ ਹ ਬ੍ਰਦਰ ਮੈਨੂੰ ਹੀ ਖਾਣਾ ਬਣਾਉਣ ਲਈ ਕਹਿੰਦੇ ਹਾਂ ਕਿ ਤੂੰ ਬਹੁਤ ਅੱਛਾ ਖਾਣਾ ਬਣਾਉਂਦੀ ਹਾਂ ਜਿਵੇਂ ਕਿ ਚਿਕਨ ਵਗੈਰਾ ਕੁਛ ਵੀ ਬਣਾਉਣਾ ਹੋਵੇ ਅਤੇ ਉਹ ਮੈਨੂੰ ਵੀ ਕਹਿੰਦੇ ਹਨ ਕਿ ਤੈਨੂੰ ਵਧੀਆ ਬਣਾਉਣਾ ਆਉਂਦਾ ਹੈ ਤੂੰ ਬਣਾਏਂਗੀ ਤੇ ਧੰਨਵਾਦ